ਹਾਂਜੀ ਸਭ ਤੋਂ ਪਹਿਲਾਂ ਮੈਂ ਪਰਿਵਾਹਨ ਸੇਵਾ ਸਹਾਇਤਾ ਜਿਹੜੀ ਸਾਈਟ ਬਣੀ ਹੋਈ ਹੈ ਇਹਨਾਂ ਦੀ ਉਸ 'ਤੇ ਜਾਵਾਂਗਾ ਅਤੇ ਉਹਨਾਂ ਦਾ ਈਮੇਲ ਐਡਰੈਸ ਉੱਥੋਂ ਦੇਖਾਂਗਾ ਫਾਇੰਡ ਕਰਾਂਗਾ ਉਹਨਾਂ ਦਾ ਈਮੇਲ ਐਡਰੈਸ ਦੇ ਉੱਪਰ ਨੂਨ ਮੈਂ ਲੋਗਿਨ ਕਰਕੇ ਠੀਕ ਹੈ ਜੀ ਤਾਂ ਉਹਦੇ ਵਿੱਚ ਜਿਹੜਾ ਮੈਂ ਆਪਣਾ ਇਹ ਜਿਹੜਾ ਉਹਨਾਂ ਨੂੰ ਪੁੱਛ ਗਿੱਛ ਕਰਨਾ ਇਹ ਚਾਹੁੰਨਾ ਗਾ ਵੀ ਜਿਹੜੀ ਕਿ ਮੈਂ ਨਾ ਆਪਣੀ ਨਵੀਂ ਟੈਕਸੀ ਖਰੀਦਣ ਦੀ ਮੈਂ ਵਿਚਾਰ ਕਰ ਰਿਹਾ ਹੈਗਾ ਅਤੇ ਉਹਦੇ ਲਈ ਮੈਂ ਲੋਨ ਲੈਣਾ ਚਾਹੁੰਨਾ ਗਾ ਅਤੇ ਜਿਹੜਾ ਲੋਨ ਦਾ ਨਾ ਮੈਨੂੰ ਇਹਦੀ ਕੋਈ ਵੀ ਪਰੀਕਿਰਿਆ ਨਹੀਂ ਮੈਨੂੰ ਹੈਗਾ ਪਤਾ ਵੀ ਕਿਵੇਂ ਕਿਵੇਂ ਇਹਨੂੰ ਮਿਲਣਾ ਠੀਕ ਹੈ ਕਿਵੇਂ ਅਪਲਾਈ ਕਰ ਸਕਦਾ ਕੀ ਕੀ ਡਾਕੂਮੈਂਟਸ ਮੈਨੂੰ ਦੇਣੇ ਹੋਣਗੇ ਅਤੇ ਕਿੱਥੇ ਅਪਲਾਈ ਕਰਨਾ ਹੈਗਾ ਤਾਂ ਜਿਹੜਾ ਕੀ ਹੈ ਮੈਂ ਜਿਹੜਾ ਕਿ ਇਸ ਟੀਮ ਨੂੰ ਤੁਹਾਡੀ ਨੂੰ ਕੀ ਹੈਗਾ ਸੈਟਰਡੇ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿਤੇ ਨਾ ਤੁਸੀਂ ਮੇਰਾ ਮਾਰਗਦਰਸ਼ਨ ਕਰੋ ਕਿ ਮੈਨੂੰ ਕਿਵੇਂ ਲੋਨ ਨੂੰ ਹੋਰ ਅੱਗੇ ਵਧਾ ਸਕਦਾ ਗਾ ਕਿ ਕਿਵੇਂ ਡਾਕੂਮੈਂਟ ਪੇਸ਼ ਕਰਦਾ ਕਿਹੜੀ ਕਿਹੜੀਆਂ ਚੀਜ਼ਾਂ ਦੀ ਮੈਨੂੰ ਜ਼ਰੂਰਤ ਹੈਗੀ ਕਿਉਂਕਿ ਮੈਨੂੰ ਇਹਨਾਂ ਤੋਂ ਕਰਜ਼ੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਮੈਂ ਇੱਕ ਨਵੀਂ ਟੈਕਸੀ ਲੈਣੀ ਹੈਗੀ ਅਤੇ ਮੈਨੂੰ ਆਸ ਆ ਕਿ ਤੁਸੀਂ ਨਾ ਜਿਹੜੇ ਮੇਰੀ ਸਹਾਇਤਾ ਜ਼ਰੂਰ ਕਰੋਗੇ ਨਾਲ ਮੈਂ ਤੁਹਾਨੂੰ ਆਪਣਾ ਫੋਨ ਨੰਬਰ ਵੀ ਇਹਦੇ ਨਾਲ ਅਟੈਚ ਕੀਤਾ ਹੈਗਾ ਹਾਂਜੀ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੇ ਤੁਸੀਂ ਮੇਰੀ ਇਸ ਵਿਸ਼ੇ ਦੇ ਵਿੱਚ ਸਹਾਇਤਾ ਕਰੋਗੇ ਜੀ ਬਹੁਤ ਬਹੁਤ ਧੰਨਵਾਦ ਥੈਂਕਸ